ਮੈਨੂੰ ਲੱਗਦਾ ਹੈ ਕਿ ਹਰੇਕ ਇਨਸਾਨ ਵਿੱਚ ਮੋਰਲ ਵੈਲਿਊਜ ਹੋਣੀਆਂ ਬਹੁਤ ਜ਼ਰੂਰੀ ਹਨ ਹਰ ਇੱਕ ਵਿਅਕਤੀ ਵਿੱਚ ਸਹਿਣਸ਼ੀਲਤਾ ਨਿਮਰਤਾ ਇਨਸਾਨੀਅਤ ਹੋਣੀ ਚਾਹੀਦੀ ਹੈ ਤਾਂ ਹੀ ਇੱਕ ਇਨਸਾਨ ਦੂਸਰੇ ਇਨਸਾਨ ਦਾ ਦੁੱਖ ਦਰਦ ਤਕਲੀਫ ਸਮਝ ਸਕਦਾ ਹੈ ਹਰ ਇੱਕ ਇਨਸਾਨ ਦੂਸਰੇ ਇਨਸਾਨ ਦਾ ਦੁੱਖ ਸਮਝਣ ਵਾਲਾ ਹੋਣਾ ਚਾਹੀਦਾ ਹੈ ਗਰੀਬ ਦੀ ਮਦਦ ਕਰਨ ਵਾਲਾ ਹੋਣਾ ਚਾਹੀਦਾ ਹੈ ਤਾਂ ਹੀ ਗਰੀਬ ਇਨਸਾਨ ਵੀ ਕਿਸੇ ਤੋਂ ਮਦਦ ਲੈਣ ਲਈ ਮਨਜ਼ੂਰ ਹੋਵੇ ਮੈਂ ਸਮਾਜ ਅਤੇ ਮਨੁੱਖਾਂ ਬਾਰੇ ਅਸਲ ਅਪਮਾਨਜਨਕ ਗੱਲਾਂ ਨਹੀਂ ਲਿਖਦੀ ਹਾਂ ਕਿਉਂਕਿ ਹਰ ਇੱਕ ਇਨਸਾਨ ਵਾਹਿਗੁਰੂ ਦਾ ਬਣਾਇਆ ਹੋਇਆ ਹੈ ਕੋਈ ਵੀ ਇਨਸਾਨ ਗਰੀਬ ਜਾਂ ਬੁਰਾ ਨਹੀਂ ਹੁੰਦਾ ਹੈ ਇਨਸਾਨ ਤਾਂ ਹੀ ਬੁਰਾ ਹੁੰਦਾ ਹੈ ਕਈ ਵਾਰ ਉਹਨਾਂ ਦੇ ਹਾਲਾਤ ਮਾੜੇ ਹੁੰਦੇ ਹਨ ਸਮਾਂ ਮਾੜਾ ਹੁੰਦਾ ਹੈ ਤਾਂ ਹੀ ਇਨਸਾਨ ਬੁਰਾ ਅਤੇ ਗਰੀਬ ਹੁੰਦਾ ਹੈ ਕੋਈ ਵੀ ਇਨਸਾਨ ਗਲਤ ਨਹੀਂ ਹੁੰਦਾ ਸਿਰਫ ਹਾਲਾਤ ਹੀ ਇਨਸਾਨ ਨੂੰ ਗਲਤ ਬਣਾਉਂਦੇ ਹਨ ਧੰਨਵਾਦ